ਮੈਂ ਸਿੱਖ ਧਰਮ ਨੂੰ ਸਬੰਧਿਤ ਹਾਂ ਅਤੇ ਜਿਹੜੇ ਸਾਡੇ ਧਰਮ ਦੇ ਅਤੇ ਭਾਈਚਾਰਾ ਜਿਹੜਾ ਇੱਥੇ ਸਾਡੇ ਧਾਰਮਿਕ ਤਿਉਹਾਰ ਨੇ ਉਹ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਗੁਰਪੁਰਬਾਂ ਦੇ ਮੌਕੇ ਦੇ ਉੱਤੇ ਇੱਕਠੇ ਹੁੰਦੇ ਹਾਂ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਅਸੀਂ ਉਸਦੀ ਸ਼ੁਰੂਆਤ ਕਰਦੇ ਹਾਂ